ਪੰਜਾਬੀ 'ਚ ਅਨੁਵਾਦ ਦਾ ਅਨੁਭਵ ਵਧੀਆ ਰਿਹਾ ਬਚਪਨ ਵਿੱਚ ਬਿਹਾਰ ਤੋਂ ਪਰਵਾਸੀ ਮਜ਼ਦੂਰ ਸਾਡੇ ਖੇਤਾਂ ਵਿੱਚ ਕੰਮ ਕਰਨ ਆਉਂਦੇ ਸਨ ਅਨਪੜ੍ਹਤਾ ਹੋਣ ਕਾਰਨ ਸਾਡੇ ਬਜੁਰਗਾਂ ਨੂੰ ਉਹਨਾਂ ਦੀ ਹਿੰਦੀ ਭਾਸ਼ਾ ਸਮਝ ਨਹੀਂ ਆਉਂਦੀ ਸੀ ਅਸੀਂ ਸਕੂਲਾਂ ਵਿੱਚੋਂ ਹਿੰਦੀ ਸਿੱਖ ਗਏ ਸੀ ਅਸੀਂ ਉਹਨਾਂ ਦੀ ਬੋਲੀ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਸਾਡੇ ਬਜ਼ੁਰਗਾਂ ਨੂੰ ਦੱਸਦੇ ਸੀ ਇਹਨੂੰ ਅਨੁਭਵ ਇੰਨਾ ਵਧੀਆ ਰਿਹਾ ਕਿ ਮੈਨੂੰ ਸਾਰੇ ਖੇਤਾਂ ਵਾਲੇ ਅਨੁਵਾਦਕ ਦੇ ਤੌਰ 'ਤੇ ਖੇਤਾਂ ਵਿੱਚ ਲਿਜਾਣ ਲੱਗ ਪਏ ਪਰ ਅਜੋਕੇ ਪੰਜਾਬ ਦੇ ਮਾਹੌਲ ਦੇ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਪੰਜਾਬੀ ਸਮਝ ਆਉਣ ਲੱਗ ਪਈ ਅਤੇ ਖੇਤਾਂ ਵਾਲੇ ਪੰਜਾਬੀ ਕਿਸਾਨਾਂ ਨੂੰ ਹਿੰਦੀ ਸਮਝਣ ਲੱਗ ਪਏ ਇੱਕ ਹੋਰ ਕਹਾਣੀ ਜਿਸ ਸਮੇਂ ਜਿਸ ਵਿੱਚ ਅੰਗਰੇਜ਼ੀ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਗੱਲ ਇਸ ਤਰ੍ਹਾਂ ਹੈ ਵੋਟਾਂ ਦਾ ਸਮਾਂ ਸੀ ਸਾਡੇ ਪਿੰਡ ਸੀ ਆਰ ਪੀ ਐਫ ਦੇ ਜਵਾਨਾਂ ਦੀ ਡਿਊਟੀ ਲੱਗੀ ਜਿਨ੍ਹਾਂ ਵਿੱਚੋਂ ਕੁਝ ਜਵਾਨ ਕੇਰਲਾ ਸਾਇਡ ਦੇ ਸੀ ਜਿਨ੍ਹਾਂ ਨੂੰ ਨਾ ਤਾਂ ਪੰਜਾਬੀ ਆਉਂਦੀ ਸੀ ਨਾ ਹਿੰਦੀ ਆਉਂਦੀ ਸੀ ਉਹਨਾਂ ਨੂੰ ਮੈਡੀਕਲ ਦਵਾਈ ਦੀ ਲੋੜ ਪਈ ਉਹਨਾਂ ਨੇ ਸਾਡੇ ਭੀਖੀ ਦੇ ਸ਼ਾਰਦਾ ਮੈਡੀਕਲ ਹਾਲ ਤੋਂ ਦਵਾਈ ਮੰਗੀ ਉਹ ਅੰਗਰੇਜ਼ੀ ਭਾਸ਼ਾ ਵਿੱਚ ਬੋਲਿਆ ਦੁਕਾਨ 'ਤੇ ਮੇਰੇ ਦੋਸਤ ਦਾ ਮੁਲਾਜ਼ਮ ਖੜ੍ਹਾ ਸੀ ਜਿਸ ਨੂੰ ਨਾ ਤਾਂ ਅੰਗਰੇਜ਼ੀ ਆਉਂਦੀ ਸੀ ਅਤੇ ਨਾ ਹਿੰਦੀ ਆਉਂਦੀ ਸੀ ਮੈਂ ਉਹਨਾਂ ਦੀ ਅੰਗਰੇਜ਼ੀ ਭਾਸ਼ਾ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਉਸ ਨੂੰ ਸਮਝਾਇਆ ਤਾਂ ਉਸਨੇ ਉਹਨਾਂ ਨੂੰ ਦਵਾਈ ਦੇ ਦਿੱਤੀ